ਸਾਡੇ ਪਿੰਡ ਵਿੱਚ ਜਿਵੇਂ ਕਿ ਪਸ਼ੂ ਪਾਲਕ ਬਹੁਤ ਹਨ ਅਤੇ ਸਰਕਾਰ ਨੇ ਉਹਨਾਂ ਲਈ ਨਿਯਮ ਵੀ ਲਾਗੂ ਕੀਤੇ ਹਨ ਜਿਵੇਂ ਕਿ ਹਰੇਕ ਮਹੀਨੇ ਜਿਵੇਂ ਕਿ ਨਵੀਆਂ ਬਿਮਾਰੀਆਂ ਚੱਲ ਪੈਂਦੀਆਂ ਹਨ ਉਹਦੇ ਵਾਸਤੇ ਸਰਕਾਰ ਨੇ ਹਰੇਕ ਮਹੀਨੇ ਇੱਕ ਸਕੀਮ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਸਰਕਾਰੀ ਡੌਕਟਰ ਆਉਂਦੇ ਹਨ ਅਤੇ ਉਹ ਪਸ਼ੂ ਪਾਲਕਾਂ ਦਾ ਪਸ਼ੂ ਪਸ਼ੂਆਂ ਦਾ ਪੂਰਾ ਟੈਸਟ ਕਰਦੇ ਹਨ ਅਤੇ ਉਹਨਾਂ ਦੇ ਇੰਜੈਕਸ਼ਨ ਲਗਾ ਕੇ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਕਲੀਫ਼ ਨਾ ਹੋਵੇ ਅਤੇ ਉਹ ਤੰਦਰੁਸਤ ਰਹਿਣ ਇਹ ਅਤੇ ਇਹ ਸਰਕਾਰ ਦਾ ਬਹੁਤ ਹੀ ਵੱਡਾ ਜੋ ਜੋ ਕਿ ਮੁਹਿੰਮ ਹੈ ਬਹੁਤ ਹੀ ਲਾਭਦਾਇਕ ਹੈ ਪਸ਼ੂ ਪਾਲਕਾਂ ਲਈ ਇਸ ਨਾਲ ਪਸ਼ੂ ਪਾਲਕ ਵੀ ਖੁਸ਼ ਰਹਿੰਦੇ ਹਨ ਅਤੇ ਪਸ਼ੂ ਵੀ ਤੰਦਰੁਸਤ ਰਹਿੰਦੇ ਹਨ ਅਤੇ ਇਹ ਸੁਵਿਧਾ ਸਰਕਾਰ ਵੱਲੋਂ ਫ੍ਰੀ ਹੈ ਅਤੇ